ਹੈਲੋ ਹੈਲੋ ਸਰ ਮੈਂ ਨਾ ਇਹ ਕਹਿਣਾ ਸੀ ਕਿ ਮੇਰਾ ਨਾ ਜਸਪ੍ਰੀਤ ਸਿੰਘ ਦੇ ਨਾਂ 'ਤੇ ਇੱਕ ਸਿਲੰਡਰ ਬੁੱਕ ਹੋਣਾ ਜਸਪ੍ਰੀਤ ਸਿੰਘ ਦੇ ਨਾਮ 'ਤੇ ਸਿਲੰਡਰ ਸਰ ਮੈਂ ਤੁਹਾਨੂੰ ਕਹਿਣਾ ਸੀ ਮੇਰੇ ਨਾ ਘਰਦਾ ਨਾ ਸਿਲੰਡਰ ਜਲ ਖ਼ਤਮ ਹੋ ਚੁੱਕਾ ਮੈਨੂੰ ਅਰਜੈਂਟ ਚਾਹੀਦਾ ਸਰ ਹੁਣ ਇੱਕ ਘੰਟੇ ਤੱਕ ਹਾਂਜੀ ਹਾਂਜੀ ਕੋਸ਼ਿਸ਼ ਕਰਿਓ ਕਿਉਂਕਿ ਮੇਰੇ ਘਰ ਦਾ ਸਿਲੰਡਰ ਖ਼ਤਮ ਹੋ ਚੁੱਕਾ ਅਰਜੈਂਟ ਚਾਹੀਦਾ ਜੇ ਹਾਂਜੀ ਥੈਂਕ ਯੂ ਭਾਅ ਜੀ ਥੈਂਕ ਯੂ ਓਕੇ ਓਕੇ